ਹਾਂਜੀ ਸਾਨੂੰ ਲੱਗਦਾ ਹੈ ਕਿ ਅਗਲੇ ਆਉਣ ਵਾਲੇ ਕੁਝ ਸਾਲਾਂ ਵਿੱਚ ਸਾਡੇ ਨਿਜੀ ਜੀਵਨ ਅਤੇ ਰ ਰਹੀਆਂ ਤਕਨੀਕੀਆਂ ਰੁਝਾਨਾਂ ਦਾ ਨਵੀਨਤਾਵਾਂ ਦਾ ਸਭ ਤੋਂ ਵੱਡਾ ਪ੍ਰਭਾਵ ਪਵੇਗਾ ਜਿਵੇਂ ਕਿ ਅੱਜ ਦੇ ਸਮੇਂ ਵਿੱਚ ਕੰਪਿਊਟਰ ਰਾਹੀਂ ਸਾਰੇ ਕੰਮ ਘਰ ਬੈਠੇ ਹੀ ਹੋ ਜਾਂਦੇ ਹਨ ਨਾ ਕਿਸੇ ਨੂੰ ਬਾਹਰ ਜਾਣ ਦੀ ਜ਼ਰੂਰਤ ਹੈ ਨਾ ਕਿਸੇ ਨੂੰ ਮਿਲਣ ਦੀ ਜ਼ਰੂਰਤ ਹੈ ਅਤੇ ਨਾ ਹੀ ਕਿਸੇ ਨੂੰ ਗੱਲਬਾਤ ਕਰਨ ਦੀ ਜ਼ਰੂਰਤ ਹੈ ਜੋ ਕਿ ਪਹਿਲਾਂ ਦੇ ਸਮੇਂ ਵਿੱਚ ਹਰ ਚੀਜ਼ ਨੂੰ ਹੱਥੀਂ ਕਰਨਾ ਜ਼ਰੂਰੀ ਸਮਝਿਆ ਜਾਂਦਾ ਸੀ ਪਰ ਅੱਜ ਦੀ ਟੈਕਨੋਲੋਜੀ ਦੇ ਕਰਕੇ ਘਰ 'ਚ ਬੈਠੇ ਹੀ ਸਾਰੇ ਕੰਮ ਉਪਲਬਧ ਹਨ ਜਿਸ ਦੀ ਵਰਤੋਂ ਦੇ ਨਾਲ ਕੰਮ ਤਾਂ ਸੁਖਾਲਾ ਹੋ ਜਾਂਦਾ ਹੈ ਪਰੰਤੂ ਇਸ ਦੀ ਮਦਦ ਦੇ ਨਾਲ ਨਾਲ ਸਾਡਾ ਸਰੀਰਿਕ ਮਾਨਸਿਕ ਅਤੇ ਦਿਮਾਗੀ ਤੌਰ 'ਤੇ ਵੀ ਅਸੀਂ ਕਮਜ਼ੋਰ ਹੋ ਸਕਦੇ ਹਾਂ